ਜਦੋਂ ਤੋਂ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਮੈਂ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਡੂੰਘੀ ਤਬਦੀਲੀ ਦੇਖੀ ਹੈ ਕਿਵੇਂ ਜਿਵੇਂ ਮੈਂ ਪਹਿਲਾਂ ਸੁਬਹਾ ਜਲਦੀ ਉੱਠਣਾ ਮੇਰੇ ਲਈ ਬਹੁਤ ਹੀ ਜ਼ਿਆਦਾ ਔਖਾ ਕੰਮ ਸੀ ਪਰ ਜਿਵੇਂ ਜਿਵੇਂ ਮੈਂ ਇੱਕ ਦਿਨ ਦੋ ਦਿਨ ਧੱਕੇ ਨਾਲ ਉੱਠੀ ਅਤੇ ਜਦੋਂ ਯੋਗਾ ਕਰਕੇ ਮੇਰਾ ਪੂਰਾ ਦਿਨ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਫਰੈਸ਼ ਜਾਂਦਾ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਯੋਗਾ ਦਾ ਕਿੰਨਾ ਜ਼ਿਆਦਾ ਮੈਨੂੰ ਲਾਭ ਮਿਲ ਰਿਹਾ ਮੇਰੇ ਸਰੀਰ ਨੂੰ ਕਿਉਂਕਿ ਸਰੀਰ ਪੂਰਾ ਟਾਈਮ ਸਰੀਰ ਵਿੱਚ ਬਹੁਤ ਜ਼ਿਆਦਾ ਊਰਜਾ ਬਹੁਤ ਐਨਰਜੀ ਰਹਿੰਦੀ ਸੀ ਸਾਰਾ ਕੰਮ ਵੀ ਬਹੁਤ ਵਧੀਆ ਹੁੰਦਾ ਸੀ ਦਿਨ ਬਹੁਤ ਵਧੀਆ ਸ਼ੁਰੂ ਹੀ ਦਿਨ ਜਦੋਂ ਵਧੀਆ ਹੁੰਦਾ ਤਾਂ ਤੁਸੀਂ ਸਾਰਾ ਦਿਨ ਖੁਸ਼ ਰਹਿੰਦੇ ਹੋ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹੋ ਬਹੁਤ ਹੀ ਜ਼ਿਆਦਾ ਤੁਹਾਨੂੰ ਖੁਸ਼ੀ ਮਿਲਦੀ ਹੈ ਕਿ ਤੁਸੀਂ ਹਾਂ ਦਿਨ ਵਿੱਚ ਇੱਕ ਇੱਕ ਕੰਮ ਤਾਂ ਸ਼ੁਰੂ ਕੀਤਾ ਉਹ ਵੀ ਬਹੁਤ ਵਧੀਆ ਅਤੇ ਜਿਹੜੀਆਂ ਉਹ ਸਾਹ ਵਾਲੀਆਂ ਐਕਸਰਸਾਈਜਜ ਕਰਵਾਉਂਦੇ ਆ ਬਰੀਦਿੰਗ ਐਕਸਰਸਾਈਜ਼ ਬੋਲਦੇ ਆ ਉਹਨਾਂ ਨੂੰ ਜਿਹੜੇ ਉਹ ਅਨੁਲੋਮ ਵਿਲੋਮ ਅਤੇ ਹੋਰ ਨਾੜੀ ਸ਼ੋਧਨ ਪਰਾਣਾਯਾਮ ਕਰਵਾਉਂਦੇ ਹੈ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਮੇਰੇ ਪਹਿਲਾਂ ਕੀ ਹੁੰਦਾ ਸੀਗਾ ਕਿ ਮੈਨੂੰ ਐਸੀਡਿਟੀ ਦੀ ਬਹੁਤ ਪ੍ਰੋਬਲਮ ਰਹਿੰਦੀ ਸੀ ਉਹ ਹੁਣ ਕਿਉਂਕਿ ਬੈਠੇ ਰਹਿੰਦੇ ਸੀ ਤਾਂ ਮੋਢੇ ਬਹੁਤ ਦੁੱਖਦੇ ਸੀ ਬੈਠ ਕੇ ਸਾਰਾ ਦਿਨ ਕੰਪਿਊਟਰ 'ਤੇ ਕੰਮ ਕਰਨਾ ਤਾਂ ਮੋਢੇ ਬਹੁਤ ਜ਼ਿਆਦਾ ਦੁੱਖਦੇ ਸੀ ਉਹ ਮੋਢੇ ਵੀ ਦੁਖਣੇ ਹੱਟ ਗਏ ਕਿਉਂਕਿ ਉਹ ਜ ਜਿਹੜੀਆਂ ਜਿਹੜੀਆਂ ਕਸਰਤਾਂ ਕਰਵਾਉਂਦੇ ਸੀ ਉਹ ਕਸਰਤਾਂ ਕਰਨ ਨਾਲ ਮੋਢੇ ਵੀ ਨਹੀਂ ਦੁਖਦੇ ਪਿੱਠ ਕਿਉਂਕਿ ਮੈਂ ਜਦੋਂ ਪੀ ਐਚ ਡੀ ਕਰ ਰਹੀ ਸੀ ਤਾਂ ਮੇਰੀ ਪਿੱਠ ਬਹੁਤ ਦੁੱਖਦੀ ਸੀ ਫਿਰ ਹੁਣ ਪਿੱਠ ਵੀ ਬਿਲਕੁਲ ਨਹੀਂ ਦੁਖਦੀ ਸਿਰਫ਼ ਪੰਨਤਾਲੀ ਮਿਨਟ ਕੱਢਣ ਲਈ ਯੋਗਾ ਦੇ ਪੰਨਤਾਲੀ ਮਿਨਟ ਕੱਢਣ ਦੇ ਨਾਲ ਹੀ ਮੈਂ ਆਪਣੇ ਲਾਈਫ ਵਿੱਚ ਬਹੁਤ ਹੀ ਜ਼ਿਆਦਾ ਆਪਣੇ ਜੀਵਨ 'ਚ ਬਹੁਤ ਡੂੰਘੀ ਤਬਦੀਲੀ ਵੇਖੀ ਫਿਰ ਮੈਂ ਆਪਣੇ ਨਾਲ ਦੇ ਲੋਕਾਂ ਨੂੰ ਸਭ ਨੂੰ ਕਿਹਾ ਆਪਣੇ ਮੰਮੀ ਪਾਪਾ ਨੂੰ ਕਿ ਤੁਸੀਂ ਵੀ ਯੋਗਾ ਕਰਨਾ ਸ਼ੁਰੂ ਕਰੋ ਅਤੇ ਇਹ ਤਬਦੀਲੀ ਕਾਇਮ ਰੱਖੋ ਸਿਰਫ਼ ਇਹ ਨਹੀਂ ਕਿ ਚਾਰ ਦਿਨ ਕਰ ਲਿਆ ਪੰਜ ਦਿਨ ਕਰ ਲਿਆ ਇਸ ਤਬਦੀਲੀ ਨੂੰ ਕਾਇਮ ਰੱਖੋ ਇਸ ਤਬਦੀਲੀ ਨੂੰ ਕਾਇਮ ਰੱਖਣ ਲਈ ਬਸ ਇੱਕ ਕੰਮ ਕਰਨਾ ਹੈ ਮੈਟ ਚੁੱਕੋ ਅਤੇ ਉੱਠ ਕੇ ਬੈਠ ਜਾਓ ਇੱਕ ਵਾਰ ਤੁਸੀਂ ਮੈਟ 'ਤੇ ਪਹੁੰਚ ਗਏ ਤਾਂ ਤੁਸੀਂ ਜ਼ਰੂਰ ਹੀ ਕਸਰਤ ਕਰੋਗੇ ਹੀ ਕਰੋਗੇ ਬਸ ਇਹ ਤਬਦੀਲੀ ਨੂੰ ਪਾ ਲਓ ਅਤੇ ਹਮੇਸ਼ਾ ਖੁਸ਼ ਰਹੋ